ਲੀਡਰਸ਼ਿਪ ਸਮਾਜਿਕ ਪ੍ਰਭਾਵ ਦੀ ਇੱਕ ਪ੍ਰਕਿਰਿਆ ਹੈ ਜੋ ਇੱਕ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਟੀਮ ਅਤੇ ਯਤਨਾਂ ਨੂੰ ਵੱਧ ਤੋਂ ਵੱਧ ਕਰਦੀ ਹੈ ਇਹ ਹੁਨਰ ਲੋਕਾਂ ਦੇ ਸਮੂਹ ਨੂੰ ਇੱਕ ਸਾਂਝੇ ਟੀਚੇ ਵੱਲ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ ਕਲਾ ਹੈ ਵਿਸ਼ੇਸ਼ਤਾ ਸਿਧਾਂਤ ਦੇ ਅਨੁਸਾਰ ਕੁਝ ਲੋਕ ਲੀਡਰਸ਼ਿਪ ਲਈ ਢੁੱਕਵੇਂ ਗੁਣ ਪ੍ਰਾਪਤ ਕਰਦੇ ਹਨ ਜਿਵੇਂ ਕੁਝ ਲੋਕਾਂ ਕੋਲ ਜਨਮ ਤੋਂ ਹੀ ਸੰਗੀਤ ਦਾ ਜਾਂ ਖੇਡਾਂ ਲਈ ਵਿਸ਼ੇਸ਼ ਤੋਹਫ਼ਾ ਹੁੰਦਾ ਹੈ ਉਹ ਕੁਦਰਤੀ ਤੌਰ 'ਤੇ ਉਸ ਖੇਤਰ ਵਿੱਚ ਵੱਖਰੇ ਵੱਖਰੇ ਹਨ ਜਦੋਂ ਕਿ ਦੂਜਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਨਤੀਜੇ ਵਜੋਂ ਬਹੁਤ ਸਾਰੇ ਲੋਕ ਸੁਭਾਵਿਕ ਗੁਣਾਂ ਵਾਲੇ ਜਨਮ ਨੇਤਾ ਹੁੰਦੇ ਹਨ ਹਾਲਾਂਕਿ ਵਿਵਾਹਰਕ ਵਿਵਾਹਰਕ ਥਿਊਰੀ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ਼ ਸਿਖਲਾਈ ਜਾਗਰੂਕਤਾ ਅਭਿਆਸ ਅਤੇ ਅਨੁਭਵ ਦੇ ਨਾਲ ਸਿੱਖਣ ਅਤੇ ਨਿਰੀਖਣ ਦੁਆਰਾ ਚੰਗੇ ਲੀਡਰਸ਼ਿਪ ਦੇ ਹੁਨਰ ਬਣਾਏ ਜਾ ਸਕਦੇ ਹਨ ਇੱਕ ਮਹਾਨ ਨੇਤਾ ਆਪਣੀਆਂ ਕਾਬਲੀਅਤਾਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਜਾਣਦਾ ਹੈ ਜੋ ਆਪਣੇ ਜੋ ਉਹਨਾਂ ਨੂੰ ਬਹੁਤ ਸਾਰੇ ਨਵੇਂ ਹੁਨਰ ਸਿੱਖਣ ਵਿੱਚ ਮਦਦ ਕਰਦਾ ਹੈ ਉਹਨਾਂ ਦੇ ਮੌਜੂਦਾ ਹੁਨਰ ਨੂੰ ਬਿਹਤਰ ਮਨਾਉਂਦਾ ਹੈ ਅਤੇ ਨਿੱਜੀ ਵਿਕਾਸ ਦੇ ਮੌਕਿਆਂ ਦਾ ਫਾਇਦਾ ਉਠਾਉਂਦਾ ਹੈ ਇੱਕ ਨੇਤਾ ਲਈ ਕੁਝ ਕੁਦਰਤੀ ਗੁਣ ਜ਼ਰੂਰੀ ਹਨ ਪਰ ਹੋਰ ਮਹਾਨ ਲੀਡਰਸ਼ਿਪ ਗੁਣ ਕੇਵਲ ਅਨੁਭਵ ਅਤੇ ਅਭਿਆਸ ਦੁਆਰਾ ਵਿਕਸਿਤ ਹੋ ਸਕਦੇ ਹਨ ਇਸ ਲਈ ਮਜ਼ਬੂਤ ਲੀਡਰਸ਼ਿਪ ਗੁਣਾਂ ਨੂੰ ਸਿਰਫ਼ ਉਦੋਂ ਹੀ ਪੂਰਾ ਕੀਤਾ ਜਾ ਸਕਦਾ ਹੈ ਜਦੋਂ ਉਹ ਸਿੱਖਿਆ ਸਿਖਲਾਈ ਅਤੇ ਅਨੁਭਵ ਦੁਆਰਾ ਸਿਖਲਾਈ ਅਤੇ ਸੰਪੂਰਨ ਹੁੰਦੇ ਹਨ ਜਿਵੇਂ ਕਿ ਉੱਪਰ ਜਿਵੇਂ ਕਿ ਤੋਹਫ਼ੇ ਹੋਣ ਅਤੇ ਬਾਵਜੂਦ ਤੁਹਾਨੂੰ ਅਭਿਆਸ ਵਿੱਚ ਇੱਕ ਚੰਗਾ ਨੇਤਾ ਬਣਨ ਲਈ ਲੋੜੀਂਦੇ ਹੁਨਰਾਂ ਵਿੱਚ ਮੁਹਾਰਤ ਹਾਸਲ ਕਰਨ ਦੀ ਲੋੜ ਹੈ ਲੀਡਰਸ ਲੀਡਰਾਂ ਕੋਲ ਬਹੁਤ ਸਾਰੇ ਹੁਨਰ ਹੋਣੇ ਚਾਹੀਦੇ ਹਨ ਜਿਸ ਵਿੱਚ ਰਣਨੀਤਿਕ ਮਾਨਸਿਕਤਾ ਫੈਸਲੇ ਲੈਣ ਸਮੱਸਿਆ ਹੱਲ ਕਰਨਾ ਯੋਜਨਾਬੰਦੀ ਪ੍ਰਬੰਧਨ ਬਿਲਡਿੰਗ ਟਰੱਸਟ ਪ੍ਰੇਰਣਾਦਾਇਕ ਅਤੇ ਪ੍ਰੇਰਣਾ ਪ੍ਰਭਾਵਸ਼ਾਲੀ ਪ੍ਰਤੀਨਿਧੀ ਮੰਡਲ ਅਧਿਆਪਨ ਅਤੇ ਸਲਾਹਕਾਰ ਸ਼ਾਮਿਲ ਹਨ